ਰਸੋਈ ਟੂਟੀ ਵਿੱਚ ਪਾਣੀ ਆਉਣ ਦਾ ਕਾਰਨ ਕੁਝ ਹੋ ਸਕਦਾ ਹੈ ਜਿਵੇਂ ਕੋਈ ਟੂਟੀ ਦੀ ਪ੍ਰਭਾਵ ਜਾਂ ਨਲ ਵਿੱਚ ਕੋਈ ਰੁਕਾਵਟ ਸਭ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਨਲ ਦੇ ਦਬਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਜੇ ਦਬਾ ਬਹੁਤ ਘੱਟ ਹੈ ਤਾਂ ਸਿੱਧਾ ਪਾਣੀ ਦੇ ਸੋਰਸ ਜਾ ਪਾਇਪਲੈਨ ਵਿੱਚ ਸਮੱਸਿਆ ਹੋ ਸਕਦੀ ਹੈ ਤੁਸੀਂ ਆਪਣੇ ਇਲਾਕੇ ਦੇ ਪਲੰਬਰ ਨਾਲ ਸੰਪਰਕ ਕਰਕੇ ਇਸ ਬਾਰੇ ਗੱਲ ਕਰ ਸਕਦੇ ਹੋ ਤਾਂ ਕਿ ਇਹ ਸਮੱਸਿਆ ਦਾ ਨਿਕਾਲ ਲੱਭ ਸਕਨ ਤੁਸੀਂ ਥੋਟ ਨਾਲ ਵੀ ਗੱਲ ਕਰ ਸਕਦੇ ਹੋ ਕਿ ਪ੍ਰੋਫੈਸ਼ਨਲ ਮਕੈਨਿਕ ਜਾਂ ਪਾਣੀ ਦੇ ਇੰਜੀਨੀਅਰ ਦੀ ਉਹ ਸਿਥੀ ਜਾਂ ਮੁਲਾਕਾਣ ਕਰਕੇ ਸਹੀ ਸੁਝਾਅ ਦੇ ਸਕੇ